ਮੈਂ ਰੇਡੀਓ 'ਤੇ ਖਬਰਾਂ ਪੰਜਾਬੀ ਅਤੇ ਹਿੰਦੀ 'ਚ ਸੁਣਨਾ ਪਸੰਦ ਕਰਦਾ ਹਾਂ ਇਸ ਤੋਂ ਇਲਾਵਾ ਜੋ ਰੇਡੀਓ 'ਤੇ ਦ ਸ਼ਬਦ ਗੁਰਬਾਣੀ ਸ਼ਬਦ ਅਤੇ ਦਰਬਾਰ ਸਾਹਿਬ ਤੋਂ ਕੀਰਤਨ ਰਿਲੇਅ ਹੁੰਦਾ ਹੈ ਉਹ ਵੀ ਸੁਣਦਾ ਬੜਾ ਆਦੀ ਹਾਂ ਇਸ ਤੋਂ ਇਲਾਵਾ ਬੀ ਬੀ ਸੀ ਲੰਡਨ ਅਤੇ ਬਿਰਧ ਭਾਰਤੀ ਦੇ ਜੋ ਗਾਣੇ ਆਉਂਦੇ ਹਨ ਹਿੰਦੀ ਗਾਣੇ ਅਤੇ ਜਿਹੜੇ ਬੜੇ ਆਪਣੇ ਟੌਪ 'ਤੇ ਟੌਪ ਟੈਨ ਹੁੰਦੇ ਹਨ ਉਹ ਗਾਣੇ ਆਉਂਦੇ ਹਨ ਅਤੇ ਮੈਂ ਉਹਨਾਂ ਨੂੰ ਬ ਸੁਣਨਾ ਬੜਾ ਪਸੰਦ ਕਰਦਾ ਹਾਂ ਇਸ ਤੋਂ ਇਲਾਵਾ ਰੇਡੀਓ ਦੇ ਕਾਫੀ ਪ੍ਰੋਗਰਾਮ ਆਪਣਾ ਜਿਵੇਂ ਕਿ ਆਪਣਾ ਸਕਿ ਸਕਿੱਟਾਂ ਵਗੈਰਾ ਔਰ ਪੰਜਾਬੀ ਸੱਭਿਆਚਾਰ ਦੇ ਗੀਤ ਵੀ ਆਉਂਦੇ ਹਨ ਅਤੇ ਉਹ ਬੜੇ ਚੰਗੇ ਲੱਗਦੇ ਹਨ ਇਸ ਤੋਂ ਇਲਾਵਾ ਕੋਈ ਸਿੱਖਿਆ ਦਾ ਇੱਕ ਜਿੱਦਾਂ ਕਿ ਯੋਗਾ ਬਾਰੇ ਜਾਂ ਆਪਣੇ ਉਹਦੇ ਯੋਗਾ ਬਾਰੇ ਅਤੇ ਇਹਦੇ ਖੇਡਾਂ ਸੰਬੰਧੀ ਪ੍ਰੋਗਰਾਮ ਬੜੇ ਚੰਗੇ ਲੱਗਦੇ ਹਨ ਜਿਹਨਾਂ ਵਿੱਚ ਐਕਸਸਾਈਜ਼ ਵਗੈਰਾ ਕਰਵਾਉਣੀ ਕਰਨੀ ਦੱਸਦੇ ਹਨ ਅਤੇ ਇਸ ਤੋਂ ਇਲਾਵਾ ਜੋ ਪੰਜਾਬੀ ਡਰਾਮੇ ਲੜੀਵਾਰ ਡਰਾਮੇ ਆਉਂਦੇ ਹਨ ਉਹ ਵੀ ਬੜੇ ਚੰਗੇ ਲੱਗਦੇ ਹਨ ਅਤੇ ਉਹ ਵੀ ਬੜੇ ਸਿੱਖਿਆ ਦਾਇਕ ਹੁੰਦੇ ਹਨ